ਭਾਰਤ ਨੌਕਰੀ ਬਜ਼ਾਰਾਂ ਨੂੰ ਮੌਜੂਦਾ ਚੁਣੌਤੀ ਮੌਜੂਦਾ ਚੁਣੌਤੀਆਂ ਹਨ ਜਿਵੇਂ ਕਿ ਹੋ ਗਿਆ ਬੇਰੁਜ਼ਗਾਰੀ ਗੈਰ ਰਸਮੀ ਖੇਤਰ ਦਾ ਦਬਦਬਾ ਘੱਟ ਰੁਜ਼ਗਾਰੀ ਆਟੋਮੇਸ਼ਨ ਅਤੇ ਟੈਕਨੋਲੋਜੀਕਲ ਰੁਕਾਵਟ ਭਾਰਤ ਨੂੰ ਮਹੱਤਵਪੂਰਨ ਬੇਰੁਜ਼ਗਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਇਸਦੀ ਨੌਜਵਾਨ ਆਬਾਦੀ ਵਿੱਚ ਭਾਰਤ ਦੇ ਕਰਮਚਾਰੀ ਦਾ ਇੱਕ ਵੱਡਾ ਹਿੱਸਾ ਗੈਰ ਰਸਮੀ ਖੇਤਰ ਵਿੱਚ ਕੰਮ ਕਰਦਾ ਹੈ ਜਿਸ ਵਿੱਚ ਨੌਕਰੀ ਦੀ ਸੁਰੱਖਿਆ ਭਾਲ ਅਤੇ ਕਾਨੂੰਨੀ ਸੁਰੱਖਿਆ ਦੀ ਘਾਟ ਹੈ ਘੱਟ ਰੁਜ਼ਗਾਰੀ ਵਿੱਚ ਭਾਰਤ ਵਿੱਚ ਬਹੁਤ ਸਾਰੇ ਵਿਦਿਆਰਥੀ ਘੱਟ ਤਨਖਾਹ ਵਾਲੀਆਂ ਅਤੇ ਘੱਟ ਹੁਨਰ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਦੇ ਹਨ ਜੋ ਆਪਣੀ ਸਿੱਖਿਆ ਦਾ ਸੰਭਾਵਨਾ ਦਾ ਪੂਰੀ ਤਰ੍ਹਾਂ ਯੋਗਿਆ ਨਹੀਂ ਕਰਦੇ